ਜੇ ਪੰਜਾਬ ਅਤੇ ਹਰਿਆਣੇ ਵਿੱਚ ਵੇਖੀਏ ਤਾਂ ਜਿਹੜੀ ਭਾਰਤ ਸਰਕਾਰ ਦੀ ਜਿਹੜੀ ਪੋਲਿਸੀ ਹੈ ਉਹਦੇ ਮੁਤਾਬਿਕ ਕਿ ਵਣਾਂ ਦਾ ਹਿੱਸਾ ਬਾਈ ਪਰਸੈਂਟ ਹੋਣਾ ਚਾਹੀਦਾ ਪਰ ਇਹਨਾਂ ਦੋ ਰਾਜਾਂ ਵਿੱਚੋਂ ਜਿਹੜੇ ਵਣਾਂ ਦਾ ਹਿੱਸਾ ਹੈ ਕੁਦਰਤੀ ਤੌਰ 'ਤੇ ਕਿਉਂਕਿ ਖੇਤੀ ਜ਼ਿਆਦਾ ਹੋਣ ਕਰਕੇ ਅਤੇ ਮੈਦਾਨੀ ਪੱਧਰ ਇਹ ਥੋੜ੍ਹਾ ਮਾਰੂਥਲੀ ਵਾਤਾਵਰਨ ਹੋਣ ਕਰਕੇ ਇੱਥੇ ਜਿਹੜੀ ਵਣਾਂ ਦੀ ਸੰਖਿਆ ਹੈ ਉਹ ਉਸ ਤੋਂ ਵੀ ਘੱਟ ਹੈ ਅਤੇ ਇਹ ਸੱਚੇ ਆਪਾਂ ਜੰਗਲੀ ਜੀਵਾਂ ਦੀ ਗੱਲ ਕਰੀਏ ਤਾਂ ਕਿੱਥੇ ਕਿੱਥੇ ਜਿੱਥੇ ਸਰਕਾਰੀ ਥਾਵਾਂ ਨੇ ਜਾਂ ਕੁਛ ਵਣ ਹੈ ਛੋਟੇ ਮੋਟੇ ਜਿਹੜੇ ਰੁੱਖਾਂ ਦੀ ਜਿਹੜੇ ਝੁਰਮੁਟ ਹੈ ਉੱਥੇ ਥੋੜ੍ਹੀ ਜੀਵ ਰਹਿੰਦੇ ਆ ਜਿਵੇਂ ਕਿੱਥੇ ਕਿੱਥੇ ਜਿਹੜੀ ਪ੍ਰਾਕ੍ਰਿਤਕ ਤੌਰ 'ਤੇ ਤਾਂ ਨਹੀਂ ਪਰ ਬਾ ਬਾਂਦਰ ਵੀ ਰਹਿੰਦੇ ਆ ਅਤੇ ਨੀਲ ਗਾਏ ਜਿਹਨੂੰ ਰੋਜ਼ ਕਹਿੰਦੇ ਪੰਜਾਬੀ ਭਾਸ਼ਾ ਵਿੱਚ ਅਤੇ ਛੋਟੇ ਖਰਗੋਸ਼ ਅਤੇ ਹ ਜਿਹਨੂੰ ਤਿੱਤਰ ਕਹਿੰਦੇ ਆ ਆਪਾਂ ਅਤੇ ਕਈ ਤਰੀਕੇ ਦੇ ਛੋਟੇ ਛੋਟੇ ਪਕਸ਼ੀ ਸੱਪ ਅਤੇ ਇਗੋਆਨਾ ਜਿਹਨੂੰ ਅੰਗਰੇਜ਼ੀ 'ਚ ਇਗੋਆਨਾ ਅਤੇ ਪੰਜਾਬੀ 'ਚ ਗੋਅ ਕਹਿੰਦੇ ਇਹੋ ਜਿਹੇ ਕਈ ਤਰੀਕੇ ਦੇ ਜੀਵ ਰਹਿੰਦੇ ਹੈ ਅਤੇ ਪੰਜਾਬ ਦਾ ਜਿਹੜਾ ਓਰੀਐਨਟੇਸ਼ਨ ਹੈ ਅਤੇ ਪੰਜਾਬ ਦਾ ਜਿਹੜਾ ਸੋਚ ਹੈ ਪੰਜਾਬ ਦੇ ਲੋਕਾਂ ਦੀ ਅਤੇ ਧਾਰਮਿਕ ਤੌਰ 'ਤੇ ਵੀ ਉਹਨਾਂ ਦਾ ਵਿਸ਼ਵਾਸ ਹੈ ਵੀ ਕਿਸੇ ਨੂੰ ਕਿਸੇ ਵੀ ਜੀਵ ਨੂੰ ਤੰਗ ਨਾ ਕੀਤਾ ਜਾਵੇ ਅਤੇ ਉਹਦੀ ਵਿਸੇ ਬਿਨਾਂ ਕਿਸੇ ਮੰਤਵ ਤੋਂ ਉਹਨੂੰ ਮਾਰਿਆ ਨਾ ਜਾਵੇ ਹੱਤਿਆ ਨਾ ਕੀਤੀ ਜਾਵੇ ਤਾਂ ਕਰਕੇ ਜੀਓ ਅਤੇ ਜੀਨੇ ਦੋ ਜਿਹੜੀ ਉਹ ਸੋਚ ਹੈ ਕਿ ਅ ਸਭ ਸਾਰੇ ਜੀਵਾਂ 'ਚ ਕਿ ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ ਅਤੇ ਇਸ ਸੋਚ ਨਾਲ ਉਹ ਕਿਸੇ ਜੀਵ ਦੀ ਹੱਤਿਆ ਕਰਨਾ ਬੜਾ ਪਾਪ ਸਮਝਦੇ ਹੈ ਅਤੇ ਕਿਸੇ ਜੀਵ ਨੂੰ ਮਾਰਨਾ ਬੜਾ ਗਲਤ ਸਮਝਦੇ ਹੈ ਇਸ ਤੋਂ ਇਲਾਵਾ ਪੰਜਾਬ ਸਰਕਾਰ ਦੇ ਕਈ ਕਜ਼ਰਵੇਸ਼ਨ ਅ ਐਕਟ ਹੈ ਪੰਜਾਬ ਕਜ਼ਰਵੇਸ਼ਨ ਐਕਟ ਔਫ ਐਨੀਮਲਜ਼ ਐਂਡ ਇੰਨ ਵਾਇਲਡ ਲਾਈਫ ਐਕਟ ਔਫ ਨਾਇਨਟੀਨ ਸੈਵਨਟੀ ਫੋਰ ਜਿਹੜੇ ਵਣਾਂ ਜੀਵਾਂ ਦੀ ਰਕਸ਼ਾ ਦੇ ਲਈ ਇਹੋ ਜਿਹੇ ਕਈ ਐਕਟ ਹੈ ਅਤੇ ਕਮਿਊਨਿਟੀਕ ਤੌਰ 'ਤੇ ਵੀ ਜਿਹੜੇ ਕਿਸਾਨ ਲੋਕ ਹੈ ਪੰਜਾਬ ਦੇ ਲੋਕ ਹੈ ਉਹ ਕਿਸੇ ਵੀ ਜੀਵ ਨੂੰ ਜਿਵੇਂ ਟਟਹਿਰੀ ਹੁੰਦੀ ਹੈ ਉਹਦੇ ਆਂਡਿਆਂ ਨੂੰ ਅ ਅੱਡ ਕਰ ਦਿੰਦੇ ਹੈ ਅਤੇ ਉਹਨਾਂ ਦੇ ਕੋਈ ਵੀ ਜੀਵ ਨੂੰ ਨਹੀਂ ਮਾਰਦੇ ਅਤੇ ਕਿਸਾਨ ਵੀ ਸਹਿਯੋਗ ਕਰਦੇ ਇਹੋ ਜਿਹੇ ਜੀਵਾਂ ਦਾ